ਕੀ ਇਹ ਜਿਹੜੀ ਤੁਹਾਡੀ ਕੈਬ ਹੈ ਇਹ ਮੈਨੂੰ ਅੰਮ੍ਰਿਤਸਰ ਏਅਰਪੋਟ 'ਤੇ ਪੁਜਾ ਦੇਵੇਗੀ ਉੱਥੇ ਮੈਂ ਚੈੱਕ ਕੀਤਾ ਹੈ ਕਿ ਉੱਥੇ ਕਾਫੀ ਭੀੜ ਲੱਗੀ ਹੈ ਕਿਉਂ ਕਿਉਂਕਿ ਉੱਥੇ ਇੱਕ ਧਰਨਾ ਸੀ ਉਹਦੇ ਕਰਕੇ ਕਾਫੀ ਪਬਲਿਕ ਜਿਹੜੀ ਹੈ ਉਹ ਇਕੱਠੀ ਹੋਈ ਹੈ ਕੀ ਤੁਹਾਨੂੰ ਪਤਾ ਹੈ ਕੋਈ ਆਸਾਨ ਰਸਤਾ ਹੋਵੇ ਜਿਹਦੇ ਵਿੱਚ ਕਿ ਅਸੀਂ ਆਪਣੇ ਟਿਕਾਣੇ ਟਾਈਮ ਸਿਰ ਪਹੁੰਚੀਏ ਸਮੇਂ ਸਿਰ ਪਹੁੰਚੀਏ ਕਿਉਂਕਿ ਏਅਰਪੋਰਟ 'ਤੇ ਪਹੁੰਚ ਕੇ ਵੀ ਸਾਨੂੰ ਦੋ ਘੰਟੇ ਪਹਿਲਾਂ ਜਾਣਾ ਪੈਣਾ ਹੈ ਕਿਉਂਕਿ ਇਨਕੁਆਇਰੀ ਦਾ ਸਮਾਂ ਜਿਹੜਾ ਹੈ ਉਹ ਸਾਨੂੰ ਕੈਲਕੂਲੇਟ ਕਰਕੇ ਚੱਲਣਾ ਪੈਣਾ ਹੈ ਸੋ ਕਿਰਪਾ ਕਰਕੇ ਮੈਨੂੰ ਦੱਸਿਆ ਜਾਵੇ ਕਿ ਅਗਰ ਕੋਈ ਸੌਖਾ ਰਸਤਾ ਸ਼ੋਟਕਟ ਰਸਤਾ ਅਵੇਲੇਬਲ ਹੈ ਤਾਂ ਉਹ ਮੈਨੂੰ ਦੱਸਿਆ ਜਾਵੇ